ਅਸੀਂ ਪੌਦਿਆਂ ਦੀ ਕਿਸਮ ਵਿੱਚ ਮਟਰ ਦਾ ਪੌਦਾ ਹਰੀ ਮਿਰਚ ਧਨੀਆ ਫੁੱਲ ਗੋਭੀ ਪਾਲਕ ਮੇਥੀ ਆਦਿ ਦੇ ਪੌਦੇ ਉਗਾਉਂਦੇ ਹਾਂ ਅਤੇ ਵੇਲਾਂ ਵਿੱਚ ਅੰਗੂਰਾਂ ਦੀ ਵੇਲ ਧਨੀਆ ਘੀਆ ਤੋਰੀ ਦੀ ਵੇਲ ਉਗਾਉਂਦੇ ਹਾਂ